ਜਦੋਂ ਵੀ ਕੋਈ ਵਿਅਕਤੀ ਆਪਣੇ ਖੇਤਰ ਵਿੱਚ ਜ਼ਮੀਨ ਖਰੀਦਦਾ ਹੈ ਜਾਂ ਵੇਚਦਾ ਹੈ ਤਾਂ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਦੇਖਿਆ ਜਾਵੇ ਤਾਂ ਜਦੋਂ ਵੀ ਅਸੀਂ ਕੋਈ ਜ਼ਮੀਨ ਖਰੀਦਣੀ ਹੈ ਜਾਂ ਵੇਚਣੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਐਕੋਓਰੇਟ ਰੇਟ ਉਹਦਾ ਪਤਾ ਹੋਣਾ ਚਾਹੀਦਾ ਜਿਹਦੇ ਕਰਕੇ ਜਦੋਂ ਅਸੀਂ ਕਿਸੇ ਆਪਣੇ ਕਸਟਮਰ ਨੂੰ ਉਸ ਥਾਂ ਬਾਰੇ ਦੱਸੀਏ ਤਾਂ ਉਹ ਵੀ ਮਨਾ ਨਾ ਕਰੇ ਕਿ ਇਹਦਾ ਰੇਟ ਬਹੁਤ ਹੀ ਜ਼ਿਆਦਾ ਸੋ ਸਾਨੂੰ ਪਹਿਲਾਂ ਤਾਂ ਐਕੋਓਰੇਟ ਰੇਟ ਉਸਦਾ ਪਤਾ ਹੋਣਾ ਚਾਹੀਦਾ ਦੂਸਰੀ ਗੱਲ ਜਦੋਂ ਵੀ ਅਸੀਂ ਕੋਈ ਜ਼ਮੀਨ ਖਰੀਦਣੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿਤੇ ਸਰਕਾਰੀ ਦੇ ਕੰਟਰੋਲ ਵਿੱਚ ਤਾਂ ਨਹੀਂ ਆਉਂਦੀ ਜੇ ਉਹ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹੈ ਤਾਂ ਫਿਰ ਅਸੀਂ ਉਹ ਜ਼ਮੀਨ ਨੂੰ ਖਰੀਦ ਸਕਦੇ ਹਾਂ ਅਤੇ ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਉੱਥੋਂ ਦਾ ਜੋ ਮਾਲਿਕ ਹੈ ਉਹ ਕਿਸੇ ਕਰਜ਼ੇ ਦੇ ਅੰਦਰ ਤਾਂ ਨਹੀਂ ਅਤੇ ਉਸਦੀ ਐੱਨ ਓ ਸੀ ਬਾਰੇ ਵੀ ਪੁੱਛਣਾ ਚਾਹੀਦਾ ਹੈ ਅਤੇ ਇਸ ਪ੍ਰਕਾਰ ਸਾਨੂੰ ਕੋਈ ਵੀ ਚੀਜ਼ ਖਰੀਦਣੀ ਜਾਂ ਵੇਚਣੀ ਹੈ ਤਾਂ ਸਾਨੂੰ ਉਸਦੀ ਸਾਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਅਤੇ ਇਹ ਡਸੀਜ਼ਨਸ ਜਲਦਬਾਜ਼ੀ ਵਿੱਚ ਨਹੀਂ ਲਿੱਤੇ ਜਾਣੇ ਚਾਹੀਦੇ ਅਤੇ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਅਤੇ ਸਾਨੂੰ ਉਸਦੇ ਭਾਵ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਸਾਨੂੰ ਇਹੋ ਜਿਹੇ ਡਸੀਜ਼ਨ ਲੈਣੇ ਚਾਹੀਦੇ ਹਨ